ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹੁਣ ਮੈਂ ਕੁਝ ਸਮੇਂ ਪਹਿਲਾਂ ਹੀ ਬਿਲੰਡਰ ਤੋਂ ਆਪਣੇ ਜ਼ਾਇਦਾਦ ਦੇ ਦਸਤਾਵੇਜ਼ ਪ੍ਰਾਪਤ ਕੀਤੇ ਹਨ ਅਤੇ ਮੈਂ ਇਹਨਾਂ ਸਾਰੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਢੰਗ ਦੇ ਨਾਲ ਸਟੋਰ ਕਰਵਾਉਣਾ ਚਾਹੁੰਦੀ ਹਾਂ ਕਿਰਪਾ ਕਰਕੇ ਮੈਨੂੰ ਇਹਨਾਂ ਦਸਤਾਵੇਜ਼ਾਂ ਨੂੰ ਸਟੋਰ ਕਰਵਾਉਣ ਦੇ ਲਈ ਵਧੇਰੇ ਅਤੇ ਉਚਿਤ ਜਾਣਕਾਰੀ ਦਿੱਤੀ ਜਾਵੇ ਜਿਸ ਦੇ ਨਾਲ ਮੈਂ ਇਹਨਾਂ ਦਸਤਾਵੇਜ਼ਾਂ ਨੂੰ ਢੰਗ ਦੇ ਨਾਲ ਸਟੋਰ ਕਰ ਸਕਾਂ ਮੈਨੂੰ ਇੱਦਾਂ ਦੀ ਜਾਣਕਾਰੀ ਦਿੱਤੀ ਜਾਵੇ ਜਿੱਥੋਂ ਦੀ ਮੈਂ ਜਦੋਂ ਚਾਹਵਾਂ ਇਹਨਾਂ ਦਸਤਾਵੇਜ਼ਾਂ ਨੂੰ ਕਢਵਾ ਸਕਾਂ ਅਤੇ ਜਦੋਂ ਚਾਹਵਾਂ ਇਹਨਾਂ ਨੂੰ ਸਟੋਰ ਕਰਵਾ ਸਕਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਅੱਜ ਕੱਲ੍ਹ ਵਧੇਰੇ ਫਰੋਡ ਵਗੈਰਾ ਚੱਲੇ ਹੋਏ ਹਨ ਅਤੇ ਕਿਸੇ ਨੂੰ ਵੀ ਕਿਸੇ 'ਤੇ ਵੀ ਆਸਾਨੀ ਦੇ ਨਾਲ ਭਰੋਸਾ ਨਹੀਂ ਹੈ ਕਿਉਂਕਿ ਵਧੇਰੇ ਫਰੋਡਸ ਹੋਣ ਦੇ ਕਾਰਨ ਦਸਤਾਵੇਜ਼ ਜਿਵੇਂ ਕਿ ਤੁਸੀਂ ਜਾਣਦੇ ਹੋ ਬਹੁਤ ਹੀ ਜ਼ਰੂਰੀ ਕਾਗਜ਼ਾਦ ਹੁੰਦੇ ਹਨ ਜਿਨ੍ਹਾਂ ਨੂੰ ਬਹੁਤ ਸੰਭਾਲ ਕੇ ਰੱਖਣਾ ਪੈਂਦਾ ਹੈ ਅਤੇ ਆਪਾਂ ਇਹਨਾਂ ਨੂੰ ਕਿਸੇ ਹੋਰ ਨੂੰ ਵੀ ਨਹੀਂ ਫੜਾ ਸਕਦੇ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਕਿਸੇ 'ਤੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ ਇਸ ਲਈ ਮੈਨੂੰ ਇਹਨਾਂ ਦਸਤਾਵੇਜ਼ਾਂ ਨੂੰ ਉਚਿਤ ਢੰਗ ਦੇ ਨਾਲ ਅਤੇ ਸੁੱਰਖਿਅਤ ਢੰਗ ਦੇ ਨਾਲ ਸਟੋਰ ਕਰਵਾਉਣ ਦੇ ਲਈ ਕੁਝ ਜਾਣਕਾਰੀ ਦਿੱਤੀ ਜਾਵੇ ਜਾਂ ਕੁਝ ਉਪਾਅ ਦੱਸੇ ਜਾਣ ਮੈਂ ਆਪਣੇ ਨਜ਼ਦੀਕੀ ਕਿਸੇ ਦੋਸਤ ਦੇ ਮਿੱਤਰ ਤੋਂ ਵੀ ਪੁੱਛਿਆ ਸੀ ਕਿ ਇਹਨਾਂ ਦਸਤਾਵੇਜ਼ਾਂ ਨੂੰ ਸੁਰੱਖਿਅਤ ਢੰਗ ਦੇ ਨਾਲ ਮੈਂ ਕਿੱਥੇ ਸਟੋਰ ਕਰਵਾ ਸਕਦੀ ਹਾਂ ਤਾਂ ਫਿਰ ਉਹਨਾਂ ਨੇ ਮੈਨੂੰ ਇੱਕ ਇਹ ਸਲਾਹ ਦਿੱਤੀ ਕਿ ਮੈਂ ਇਹਨਾਂ ਦਸਤਾਵੇਜ਼ਾਂ ਨੂੰ ਡਿਜੀਲੋਕਰ ਦੇ ਉੱਪਰ ਸਟੋਰ ਕਰਵਾ ਸਕਦੀ ਹਾਂ ਕਿਰਪਾ ਕਰਕੇ ਮੈਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਮੈਂ ਇਹਨਾਂ ਦਸਤਾਵੇਜ਼ਾਂ ਨੂੰ ਡਿਜੀਲੋਕਰ ਦੇ ਉੱਪਰ ਕਿਵੇਂ ਅਪਲੋਡ ਕਰਾਂ ਕਿਉਂਕਿ ਮੈਂ ਮੈਨੂੰ ਡਿਜੀਲੋਕਰ ਚਲਾਉਣਾ ਨਹੀਂ ਆਉਂਦਾ ਅਤੇ ਮੈਂ ਜੀ ਅਤੇ ਮੈਂ ਇਹ ਦਸਤਾਵੇਜ਼ਾਂ ਅਤੇ ਮੈਨੂੰ ਡਿਜੀਲੋਕਰ ਹਜੇ ਚਲਾਉਣਾ ਨਹੀਂ ਆਉਂਦਾ ਕਿਉਂਕਿ ਮੈਂ ਅਜੇ ਨਵੀਂ ਨਵੀਂ ਹੀ ਆਈ ਹਾਂ ਅਤੇ ਮੈਨੂੰ ਮੋਬਾਇਲ ਜਾਂ ਇੱਦਾਂ ਦੇ ਆਨਲਾਈਨ ਕਾ ਇੰਟਰਨੈਟ ਦੇ ਜਿੰਨੇ ਵੀ ਆਨਲਾਈਨ ਸੁਵਿਧਾਵਾਂ ਹਨ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਹੈ ਕਿਰਪਾ ਕਰਕੇ ਮੈਨੂੰ ਇਹ ਵੀ ਦੱਸਿਆ ਜਾਵੇ ਕਿ ਡਿਜੀਲੋਕਰ ਦੇ ਉੱਤੇ ਮੈਂ ਆਪਣੀ ਨਵੀਂ ਆਈ ਡੀ ਕਿਵੇਂ ਬਣਾਵਾਂ ਉਸ ਉੱਪਰ ਦਸਤਾਵੇਜ਼ਾਂ ਨੂੰ ਕਿਵੇਂ ਅਪਲੋਡ ਕਰਾਂ ਅਤੇ ਅਗਰ ਮੈਂ ਇੱਕ ਵਾਰ ਉਸ ਤੇ ਆਪਣੇ ਦਸਤਾਵੇਜਾਂ ਨੂੰ ਅਪਲੋਡ ਕਰ ਦਿੱਤਾ ਤਾਂ ਮੈਂ ਅਗਰ ਜਦੋਂ ਵੀ ਮੈਨੂੰ ਜ਼ਰੂਰਤ ਪਵੇ ਉਸ ਤੋਂ ਆਪਣੇ ਦਸਤਾਵੇਜ਼ ਕਢਵਾਉਣੇ ਹਨ ਤਾਂ ਮੈਂ ਕਿਵੇਂ ਕਢਵਾਵਾਂ ਕਿਉਂਕਿ ਮੈਨੂੰ ਡਿਜੀਲੋਕਰ ਨੂੰ ਵਰਤਣਾ ਨਹੀਂ ਆਉਂਦਾ ਅਤੇ ਨਾ ਹੀ ਮੈਨੂੰ ਡਿਜੀਲੋਕਰ ਦੇ ਬਾਰੇ ਵਧੇਰੇ ਜਾਣਕਾਰੀ ਹੈ ਜਿਵੇਂ ਕਿ ਮੈਨੂੰ ਕਈਆਂ ਨੇ ਦੱਸਿਆ ਹੈ ਕਿ ਡਿਜੀਲੋਕਰ ਇੱਕ ਬਹੁਤ ਹੀ ਵਧੀਆ ਆਨਲਾਈਨ ਪਲੈਟਫੋਮ ਹੈ ਜਿਸ 'ਤੇ ਅਸੀਂ ਦਸਤਾਵੇਜ਼ਾਂ ਜਾਂ ਸਰਟੀਫਿਕੇਰਾਂ ਸਰਟੀਫਿਕੇਟਾਂ ਦੇ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹਾਂ ਅਤੇ ਉਹਨਾਂ ਦੀ ਪੁਸ਼ਟੀ ਵੀ ਕਰ ਸਕਦੇ ਹਾਂ ਤਾਂ ਇਹ ਵਦ ਵਧੇਰਾ ਸੁਰੱਖਿਅਤ ਤਰੀਕਾ ਮੰਨਿਆ ਜਾਂਦਾ ਹੈ ਜਿਸ 'ਚ ਅਸੀਂ ਆਪਣੇ ਸਾਰੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਲਈ ਸਟੋਰ ਕਰ ਸਕਦੇ ਹਾਂ ਜਿਵੇਂ ਕਿ ਮੈਨੂੰ ਕਈਆਂ ਨੇ ਇਹ ਵੀ ਦੱਸਿਆ ਹੈ ਕਿ ਡਿਜੀਲੋਕਰ ਅੱਜ ਕੱਲ੍ਹ ਵਧੇਰੇ ਵਰਤਿਆ ਜਾਂਦਾ ਹੈ ਅਤੇ ਇਸ ਲਈ ਮੈਂ ਵੀ ਡਿਜੀਲੋਕਰ ਨੂੰ ਵਰਤ ਕੇ ਆਪਣੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਲਈ ਸਟੋਰ ਕਰਨਾ ਚਾਹੁੰਦੀ ਹਾਂ ਇਸ ਲਈ ਮੈਨੂੰ ਇਸ ਦੇ ਬਾਰੇ ਵਧੇਰੇ ਜਾਣਕਾਰੀ ਦਿੱਤੀ ਜਾਵੇ